ਹੈਲੋ ਹੈਲੋ ਹਾਂਜੀ ਨਮਸਕਾਰ ਜੀ ਹਾਂਜੀ ਸਰ ਹਾਂਜੀ ਮੈਂ ਨਾ ਉਹ ਕੀ ਕਹਿੰਦੇ ਰ ਰੈਡੀਮੇਡ ਫਰਨੀਚਰ ਬਣਵਾਉਣਾ ਚਾਹੁੰਦੀ ਸੀ ਲੈਣਾ ਸੀ ਜੀ ਮੈਂ ਹਾਂਜੀ ਅਤੇ ਮੈਂ ਪੁੱਛਣਾ ਚਾਹੁੰਦੀ ਕਿ ਰੈਡੀਮੇਡ 'ਚ ਜ਼ਿਆਦਾ ਸਹੀ ਰਹੇਗਾ ਜਾਂ ਜੇ ਖੁਦ ਬਣਵਾਇਆ ਜਾਏ ਤਾਂ ਉਹ ਸਹੀ ਰਹਿੰਦਾ ਅੱਛਾ ਉਹ ਕਿੱਦਾਂ ਠੀਕ ਹੈ ਠੀਕ ਹੈ ਹਾਂਜੀ ਅਤੇ ਅੱਛਾ ਅੱਛਾ ਠੀਕ ਹੈ ਅਤੇ ਜੇ ਮਤਲਬ ਖੁਦ ਬਣਵਾਉਣਾ ਹੋਏ ਤਾਂ ਉਹਦਾ ਠੀਕ ਹੈ ਠੀਕ ਹੈ ਹਾਂ ਠੀਕ ਹੈ ਅਤੇ ਹਾਂਜੀ ਹਾਂਜੀ ਮਤਲਬ ਉਹ ਤੁਸੀਂ ਘਰ ਆ ਕੇ ਬਣਾਓਗੇ ਜਿੱਦਾਂ ਹਾਂਜੀ ਹਾਂਜੀ ਅਤੇ ਰੈਡੀ ਹਾਂਜੀ ਹਾਂਜੀ ਅਤੇ ਉਹਦਾ ਜਿੱਦਾਂ ਆਉਣ ਜਾਣ ਦਾ ਜੇ ਖਰਚਾ ਉਹਦਾ ਆਉਣ ਜਾਣ ਦਾ ਰੈਡੀਮੇਡ ਦਾ ਜਿੱਦਾਂ ਖਰਚਾ ਉਹ ਵੀ ਵਿੱਚ ਹੀ ਠੀਕ ਹੈ ਠੀਕ ਹੈ ਅਤੇ ਉਹਦਾ ਕੀ ਕੀ ਪ੍ਰਾਈਜ਼ ਹੁੰਦਾ ਜੇ ਸੋਫਾ ਬਣਵਾਉਣਾ ਹੋਏ ਤਾਂ ਉਹਦਾ ਕੀ ਪ੍ਰਾਈਜ਼ ਹੁੰਦਾ ਠੀਕ ਠੀਕ ਹਾਂਜੀ ਠੀਕ ਆ ਜੀ ਅਤੇ ਜੇ ਨੋਰਮਲ ਜਿਹਾ ਹੀ ਬਣਵਾਉਣਾ ਹੋਏ ਤਾਂ ਠੀਕ ਆ ਠੀਕ ਆ ਅਤੇ ਬੈੱਡ ਦਾ ਕੀ ਪ੍ਰਾਈਜ਼ ਹੈ ਜੇ ਰੈਡੀਮੇਡ ਲੈਣਾ ਹੋਏ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹਾਂ ਠੀਕ ਹੈ ਨਹੀਂ ਜੀ ਮੈਂ ਸੋਫਾ ਬਣਵਾਉਣਾ ਨਾ ਮੈਂ ਤਾਂ ਪੁੱਛਣ ਡਈ ਸੀ ਹਾਂਜੀ ਕੋਈ ਨੀ ਮੈਂ ਹਾਂਜੀ ਤੁਹ ਤੁਹਾਨੂੰ ਦੁਬਾਰਾ ਕੋਲ ਕਰਾਂਗੀ ਮੈਂ ਹਾਂਜੀ ਠੀਕ ਆ ਓਕੇ ਜੀ